ਵਿਸਾਖੀ ਵਾਲੇ ਵਿਸਾਖੀ ਤੇਰ੍ਹਾਂ ਅਪ੍ਰੈਲ ਨੂੰ ਮਨਾਈ ਜਾਂਦੀ ਹੈ ਇਸ ਵਿੱਚ ਕਿਸਾਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਦਿਨ ਤੋੋਂ ਖੇਤਾਂ ਵਿੱਚ ਕਣਕ ਦੀ ਵਾਢੀ ਪੈ ਜਾਂਦੀ ਹੈ ਵਿਸਾਖੀ ਵਾਲੇ ਦਿਨ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਖੰਡੇ ਵਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਗੁਰਪੁਰਬ ਵਾਲੇ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮਦਿਨ 'ਤੇ ਗੁਰਪੂਰਬ 'ਤੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਰਹਿੰਦੇ ਸਨ ਮੈਂ ਸਾਰਾ ਦਿਨ ਗੁਰੂ ਘਰ ਵਿੱਚ ਹੀ ਸੇਵਾ ਕਰਨ ਜਾਂਦੀ ਸੀ ਗੁਰੂ ਤਾਂ ਸਾਰਾ ਦਿਨ ਚੱਲਦਾ ਰਹਿੰਦਾ ਹੈ ਬੁੱਧ ਪੂਰਨਿਮਾ ਵਾਲੇ ਦਿਨ ਦਰਖਤਾਂ ਦੇ ਆਲੇ ਦੁਆਲੇ ਦੀਵੇ ਜਲਾਏ ਜਾਂਦੇ ਸਨ ਜੜ੍ਹਾਂ ਵਿੱਚ ਦੁੱਧ ਪਾਇਆ ਜਾਂਦਾ ਹੈ ਪਿੰਜਰਿਆਂ ਵਿੱਚ ਪੰਛੀਆਂ ਨੂੰ ਮੁਕਤ ਕੀਤਾ ਜਾਂਦਾ ਹੈ ਅਤੇ ਗਰੀਬਾਂ ਨੂੰ ਭੋਜਨ ਅਤੇ ਵਸਤੂ ਦਾਨ ਕੀਤੇ ਜਾਂਦੇ ਸਨ ਦਿੱਲੀ ਵਿੱਚ ਬੁੱਧ ਧਰਮ ਦੀ ਪੂਜਾ ਕੀਤੀ ਜਾਂਦੀ ਹੈ ਧਰਮ ਗ੍ਰੰਥ ਵਿੱਚ ਵਿਸ਼ਵਕਰਮਾ ਸ੍ਰਿਸ਼ਟੀ ਨੂੰ ਰਚ ਬ੍ਰਹਮਾ ਵਿਸ਼ਵਕਰਮਾ ਬ੍ਰਹਮਾ ਜੀ ਦਾ ਇੱਕ ਅੰਗ ਮੰਨਿਆ ਜਾਂਦਾ ਹੈ ਵਾਸੂਦੇਵ ਜੋ ਕਿ

ਵਿਸ਼ਵਕਰਮਾ ਦੀ ਮਾਂ ਸੀ